ਜੀ ਹਾਂਜੀ ਮੈਂ ਸ਼ਾਰਕ ਟੈਂਕ ਸ਼ੋ ਦੇਖਦੀ ਹਾਂ ਉਹ ਤੋਂ ਮੈਂ ਜਾਣੂ ਵੀ ਹਾਂ ਉਹਦੇ ਵਿੱਚ ਲੋਕ ਜਾ ਕੇ ਜਿਸ ਤਰ੍ਹਾਂ ਆਮ ਲੋਕ ਜਾ ਕੇ ਆਪਣੇ ਪ੍ਰੋਡਕਟ ਬਣਾ ਕੇ ਉੱਥੇ ਖੜ੍ਹਦੇ ਨੇ ਉਨ੍ਹਾਂ ਦੇ ਉੱਥੇ ਚਾਰ ਪੰਜ ਮੈਨੇਜਰ ਬੈਠੇ ਹੁੰਦੇ ਵੱਡੇ ਵੱਡੇ ਕਾਰੋਬਾਰੀਆਂ ਦੇ ਵੱਡੇ ਵੱਡੇ ਕੰਪਨੀਆਂ ਦੇ ਉਹ ਜਾ ਕੇ ਉਹਨਾਂ ਨੂੰ ਆਪਣਾ ਪ੍ਰੋਡਕਟ ਵਿਖਾਉਂਦੇ ਨੇ ਉਹ ਉਹਨਾਂ ਨੂੰ ਪੁੱਛਦੇ ਨੇ ਕਿ ਇਹਦੇ ਵਿੱਚ ਕੀ ਫਾਇਦਾ ਵਾ ਸਾਡਾ ਵੀ ਮਤਲਬ ਕਿਸੇ ਦਾ ਕੋਈ ਨੁਕਸਾਨ ਤਾਂ ਨਹੀਂ ਜਾਂ ਕਿਸ ਤਰ੍ਹਾਂ ਵਾਂ ਉਹ ਦੱਸਦੇ ਨੇ ਸਾਰਾ ਕੁਛ ਉਹਨਾਂ ਨੂੰ ਕ ਕੰਪਨੀ ਵਾਲਿਆਂ ਨੂੰ ਮੈਨੇਜਰ ਨੂੰ ਜਿਹਨੇ ਸ਼ੋ ਬਣਾ ਉਹ ਖੜ੍ਹਿਆ ਹੁੰਦਾ ਆਪਣਾ ਬਣਾ ਕੇ ਪ੍ਰੋਡਕਟ ਉਹ ਦੱਸਦੇ ਨੇ ਕਿ ਇਸ ਤਰ੍ਹਾਂ ਇਹਦਾ ਆਹ ਹੈ ਆਪਾਂ ਬਣਾਇਆ ਵਾ ਇਹਦਾ ਆਹ ਫਾਇਦਾ ਹੋ ਸਕਦਾ ਵਾ ਫਿਰ ਜੇ ਉਹਨਾਂ ਨੂੰ ਮੈਨੇਜਰ ਆ ਜਿਹੜੇ ਹੁੰਦੇ ਉੱਥੇ ਬੈਠੇ ਹੁੰਦੇ ਆ ਉਹਨਾਂ ਨੂੰ ਸਹੀ ਲੱਗੇ ਤਾਂ ਉਹ ਫਿਰ ਉਹਦੀ ਬੋਲੀ ਲਗਾਉਂਦੇ ਨੇ ਉਹ ਜਿਹਨੇ ਪ੍ਰੋਡਕਟ ਬਣਾਇਆ ਹੁੰਦਾ ਵਾ ਉਹਨੂੰ ਪੈਸੇ ਦੱਸਦੇ ਨੇ ਕਿ ਅਸੀਂ ਤੈਨੂੰ ਇੰਨੇ ਪਰਸੈਂਟ ਪੈਸੇ ਦੇਵਾਂਗੇ ਅਤੇ ਪ੍ਰੋਡਕਟ ਜਿਹੜਾ ਬਣਾ ਕੇ ਤਿਆਰ ਕਰਕੇ ਸਾਨੂੰ ਦਿੱਤਾ ਜਾਵੇ ਜਦੋਂ ਪ੍ਰੋਡਕਟ ਬਣਾ ਕੇ ਉਹਨਾਂ ਨੂੰ ਜਿਨ੍ਹਾਂ ਨੂੰ ਪ੍ਰੋਡਕਟ ਬਣਾਉਣ ਵਾਲੇ ਨੂੰ ਸਹੀ ਲੱਗੇ ਵੀ ਹਾਂ ਮੇਰੇ ਲਈ ਇਹ ਫਾਇਦੇਮੰਦ ਹੈ ਫਿਰ ਉਹ ਡੀਲ ਪੱਕੀ ਕਰਕੇ ਉਹਨਾਂ ਨਾਲ ਉਹ ਪ੍ਰੋਡਕਟ ਬਣਾਉਣ ਲਈ ਹਾਂ ਕਰ ਦਿੰਦਾ ਵਾ ਫਿਰ ਉਹ ਪੈਸੇ ਲੈ ਕੇ ਆਪਣਾ ਜਿਹੜਾ ਕੰਮ ਆ ਉਹ ਚਾਲੂ ਕਰ ਲੈਂਦਾ ਵਾ ਪ੍ਰੋਡਕਟ ਬਣਾ ਕੇ ਫਿਰ ਉਹਨਾਂ ਨੂੰ ਦਿੰਦਾ ਹੈ ਵੇਚਦਾ ਹੈ ਆਪਣੀ ਬਿਜਨਸ ਵੱਡੇ ਵੱਡੇ ਬਿਜਨਸ ਕੰਪਨੀਆਂ ਵਾਲੇ ਮੈਨਜਰਾਂ ਨਾਲ ਡੀਲ ਕੀਤੀ ਹੁੰਦੀ ਜਿਹੜੀ ਫਿਰ ਆਪਣੀ ਡੀਲ ਪੱਕੀ ਕਰ ਲੈਂਦਾ ਵਾ ਅਤੇ ਕਾਰੋਬਾਰ ਸ਼ੁਰੂ ਕਰਨ ਲਈ ਆਪਾਂ ਲੋਕ ਕਿ ਇੱਦਾਂ ਪ੍ਰਭਾਵਿਤ ਵੀ ਇਹ ਤੋਂ ਬਹੁਤ ਜ਼ਿਆਦਾ ਲੋਕਾਂ ਨੂੰ ਫਾਇਦਾ ਵੀ ਹੁੰਦਾ ਪ੍ਰਭਾਵਿਤ ਵੀ ਹੋ ਜਾਂਦੇ ਲੋਕ ਜਿਨ੍ਹਾਂ ਕੋਲ ਪੈਸੇ ਨਹੀਂ ਹੁੰਦੇ ਵੀ ਆਪਣਾ ਕਾਰੋਬਾਰ ਜਿਹੜਾ ਵਾ ਉਹ ਦੂਰ ਉੱਚਾ ਖੜ੍ਹਨ ਵਾਸਤੇ ਵੱਡਾ ਕਰਨ ਵਾਸਤੇ ਉਹਨਾਂ ਕੋਲ ਪੈਸੇ ਨਹੀਂ ਹੁੰਦੇ ਫਿਰ ਉਹ ਇਹ ਜਿਹੜਾ ਸਾਰਕ ਟੈਕ ਸ਼ੋ ਵੇਖਦੇ ਨੇ ਉਹਨਾਂ ਵਿੱਚ ਜਾਂਦੇ ਨੇ ਉੱਥੇ ਜਾ ਕੇ ਆਪਣਾ ਪ੍ਰੋਡਕਟ ਬਣਾ ਕੇ ਖੜ੍ਹਦੇ ਨੇ ਉਹ ਉਹਦੇ ਰਾਹੀਂ ਉੱਥੇ ਉਹ ਪ੍ਰੋਡੈਕਟਸ ਸਮਝਾਉਂਦੇ ਕਰਦੇ ਨੇ ਫਿਰ ਉਹਨਾਂ ਨੂੰ ਚੰਗਾ ਲੱਗੇ ਉਹ ਸਹੀ ਲੱਗਦਾ ਵਾ ਫਿਰ ਉਹ ਆਪਣਾ ਉੱਥੇ ਪ੍ਰੋਡਕਟ ਵੇਚ ਕੇ ਕਰਕੇ ਫਿਰ ਉਹਨਾਂ ਕੋਲੋਂ ਪੈਸੇ ਲੈ ਕੇ ਆਪਣਾ ਪਰ ਆਪਣਾ ਕਾਰੋਬਾਰ ਆਪਣਾ ਬਿਜਨਸ ਜਿਹੜਾ ਵਾ ਉਹ ਉੱਚੇ ਤੋਂ ਉੱਚਾ ਲੈ ਕੇ ਜਾਂਦੇ ਨੇ ਅਤੇ ਇੱਦਾਂ ਲੋਕਾਂ ਨੂੰ ਫਾਇਦਾ ਵੀ ਹੁੰਦਾ ਵਾ ਲੋਕ ਸਾਰਕ ਟੈਂਕ ਸ਼ੋ ਤੋਂ ਪ੍ਰਭਾਵਿਤ ਵੀ ਬਹੁਤ ਜ਼ਿਆਦਾ ਹੁੰਦੇ ਨੇ ਬਹੁਤ ਵਧੀਆ ਸ਼ੋ ਮੈਂ ਦਾ ਦੇਖਦੀ ਹਾਂ ਇਸਨੂੰ